ਸਾਡੇ ਖੇਤਰ ਵਿੱਚ ਕਾਫੀ ਸਕੂਲ ਕਾਲਜ ਹਨ ਜੋ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕਲਾ ਦਾ ਪ੍ਰਦਰਸ਼ਨ ਵਿਦਿਆਰਥੀਆਂ ਪਾਸੋਂ ਕਰਵਾਉਂਦੇ ਹਨ ਇਹਨਾਂ ਕਾਲਜਾਂ ਵਿੱਚ ਸਰਕਾਰ ਵੱਲੋਂ ਜਿਹੜੇ ਕੋਚ ਆ ਉਹ ਵੀ ਉੱਚ ਕੋਟੀ ਦੇ ਹੀ ਲਗਾਏ ਗਏ ਹਨ ਜੋ ਕਿ ਵਿਦਿਆਰਥੀਆਂ ਦੇ ਵਿੱਚ ਇੱਕ ਕਲਾ ਰੂਪੀ ਗੁਣ ਸਾਰੇ ਗੁਣ ਭਰ ਦਿੰਦੇ ਹਨ ਕਈ ਪ੍ਰਾਈਵੇਟ ਸੰਸਥਾਵਾਂ ਵੀ ਡਾਂਸ ਆਦਿ ਵੀ ਸਿਖਾਉਂਦੇ ਹਨ ਜੋ ਕਿ ਸ਼ੋਸ਼ਲ ਮੀਡੀਆ ਰਾਹੀਂ ਵੀ ਬਹੁਤ ਪ੍ਰਚਲਿਤ ਹੈ ਕਈ ਚੈਨਲਾਂ 'ਤੇ ਵੀ ਅਜਿਹੇ ਪੰਜਾਬੀ ਪ੍ਰੋਗਰਾਮ ਆਉਂਦੇ ਹਨ ਜੋ ਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਗਾਇਕੀ ਅਤੇ ਭੰਗੜੇ ਦੀ ਸਿਖਲਾਈ ਦਿੰਦੇ ਹਨ ਜਾ ਕਿ ਤਾਂ ਜੋ ਆਪਣਾ ਉਹ ਹੋਰ ਹੁਨਰ ਨੂੰ ਨਿਖਾਰ ਸਕਣ ਅਤੇ ਇੱਕ ਚੰਗੇ ਗਾਇਕ ਜਾਂ ਮਤਲਬ ਭੰਗੜੇ ਦੇ ਵਧੀਆ ਕੋਚ ਜਾਂ ਜੋ ਵੀ ਬਣ ਸਕਣ ਧੰਨਵਾਦ